ਨਮਸਕਾਰ ਸਰ ਮੈਂ ਸਵੀਗੀ ਵਿੱਚੋਂ ਤੁਹਾਡੇ ਰੈਸਟੋਰੈਂਟ ਤੋਂ ਨਿਯਮਿਤ ਤੋਰ 'ਤੇ ਓਡਰ ਕਰਦੀ ਰਹਿੰਦੀ ਹਾਂ ਅਤੇ ਤੁਹਾਡਾ ਰੈਸਟੋਰੈਂਟ ਵੀ ਮੇਰੇ ਸਥਾਨ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਮੈਂ ਜਦੋਂ ਵੀ ਭੋਜਨ ਦੀਆਂ ਵਸਤੂਆਂ ਦਾ ਓਡਰ ਕਰਦੀ ਹਾਂ ਮੈਨੂੰ ਤੁਹਾਨੂੰ ਕੋਈ ਵੀ ਪਤਾ ਪ੍ਰਦਾਨ ਕਰਨ ਦੀ ਲੋੜ ਨਹੀਂ ਹੁੰਦੀ ਮੈਂ ਜਦੋਂ ਵੀ ਕੋਈ ਵੀ ਓਡਰ ਕਰਦੀ ਹਾਂ ਤਾਂ ਤੁਹਾਡਾ ਰੈਸਟੋਰੈਂਟ ਹਮੇਸ਼ਾ ਸਮੇਂ ਸਿਰ ਸਮਾਨ ਪਹੁੰਚਾ ਦਿੰਦਾ ਹੈ ਮੈਨੂੰ ਤੁਹਾਡੇ ਰੈਸਟੋਰੈਂਟ ਦੀ ਇਹ ਗੱਲ ਬਹੁਤ ਪਸੰਦ ਹੈ ਕਿ ਉਹ ਓਡਰ ਬਹੁਤ ਹੀ ਸਮੇਂ ਸਿਰ ਪਹੁੰਚਾ ਦਿੰਦਾ ਹੈ ਅਤੇ ਤੁਹਾਡੇ ਰੈਸਟੋਰੈਂਟ ਦਾ ਸਮਾਨ ਬਹੁਤ ਹੀ ਸੁਆਦ ਵੀ ਹੁੰਦਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਛ ਸਮੇਂ ਤੋਂ ਸਾਡਾ ਪਤਾ ਬਦਲ ਗਿਆ ਹੈ ਤੁਹਾਡਾ ਰੈਸਟੋਰੈਂਟ ਹਜੇ ਵੀ ਸਮਾਨ ਉਹ ਹੀ ਪਤੇ 'ਤੇ ਦੇਣ ਆ ਜਾਂਦਾ ਹੈ ਜਦ ਉੱਥੇ ਕੋਈ ਵੀ ਨਹੀਂ ਮਿਲਦਾ ਤਾਂ ਓਡਰ ਕੈਂਸਲ ਹੋ ਜਾਂਦਾ ਹੈ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਪਤਾ ਇੱਕ ਚਾਰ ਵਟਾ ਇੱਕ ਬਾਰਾਂ ਸੁਪਰ ਬਜ਼ਾਰ ਤਰਨਤਾਰਨ ਤੋਂ ਬਦਲ ਕੇ ਸਾਡਾ ਪਤਾ ਇੱਕ ਅੱਠ ਵਟਾ ਦੋ ਛੇ ਪੰਜ ਗਲੀ ਛਾਪੜ ਚ ਵਾਲੀ ਤਰਨਤਾਰਨ ਹੋ ਗਿਆ ਹੈ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੇ ਤੁਸੀਂ ਮੇਰਾ ਅਡਰੈਸ ਜਲਦ ਤੋਂ ਜਲਦ ਅਪਡੇਟ ਕਰ ਦਿਓ ਤਾਂ ਜੋ ਮੈਨੂੰ ਵੀ ਮੁਸ਼ਕਿਲ ਨਾ ਆਵੇ ਅਤੇ ਤੁਹਾਨੂੰ ਵੀ ਜੇ ਤੁਸੀਂ ਮੇਰਾ ਅਡਰੈਸ ਜਲਦ ਤੋਂ ਜਲਦ ਨਾ ਅਪਡੇਟ ਕੀਤਾ ਤਾਂ ਮੇਰਾ ਸਾਮਾਨ ਗਲਤ ਅਡਰੈਸ 'ਤੇ ਆ ਜਾਵੇਗਾ ਅਤੇ ਤਾਂ ਮੇਰਾ ਸਮਾਨ ਗਲਤ ਅਡਰੈਸ 'ਤੇ ਆ ਜਾਵੇਗਾ ਅਤੇ ਤੁਹਾਡਾ ਸਮਾਨ ਵੀ ਖਰਾਬ ਹੋ ਜਾਵੇਗਾ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਪਤਾ ਜਲਦ ਤੋਂ ਜਲਦ ਬਦਲ ਦਿਓ ਤਾਂ ਤਾਂ ਜੋ ਤੁਹਾਨੂੰ ਵੀ ਮੁਸ਼ਕਿਲ ਨਾ ਆਵੇ ਅਤੇ ਮੈਨੂੰ ਵੀ ਇਸ ਕਰਕੇ ਤੁਸੀਂ ਜਲਦ ਤੋਂ ਜਲਦ ਮੇਰਾ ਪਤਾ ਬਦਲ ਦਿਓ ਤਾਂ ਜੋ ਤੁਹਾਡੇ ਲਈ ਵੀ ਰਾਹਤ ਹੋ ਜਾਵੇ ਨਹੀਂ ਤਾਂ ਤੁਹਾਡੇ ਲੋਕ ਵੀ ਚੱਕਰ ਮਾਰ ਮਾਰ ਕੇ ਥੱਕ ਜਾਣਗੇ ਪਰ ਸਮਾਨ ਮੇਰੇ ਤੱਕ ਫਿਰ ਵੀ ਨਹੀਂ ਪਹੁੰਚੇਗਾ ਇਸ ਕਰਕੇ ਤੁਸੀਂ ਮੇਰਾ ਅਡਰੈਸ ਜਲਦ ਤੋਂ ਜਲਦ ਅਪਡੇਟ ਕਰ ਦਿਓ ਧੰਨਵਾਦ